ਵਾਹਨਾਂ ਦੇ ਨਾਮ ਗੱਡੀ ਬਸ ਟਰੱਕ ਮੋਟਰਸਾਈਕਲ ਸਾਈਕਲ ਓਟੋ ਰੇਲਗੱਡੀ ਜਹਾਜ ਹੈਲੀਕੋਪਟਰ ਕਿਸ਼ਤੀ ਗੱਡਾ ਰੇੜਾ ਰਿਕਸ਼ਾ ਟਾਂਗਾ ਵੈਨ ਟੈਂਪੂ ਟਿੱਪਰ ਐਬੂਲੈਂਸ